ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੇ ਢਾਬੇ ਤੋਂ ਚਾਰ ਕੱਪ ਕੋਫੀ ਦੇ ਔਡਰ ਕੀਤੇ ਸਨ ਇਹ ਕੋਫੀ ਗਰਮ ਕੋਫੀ ਹੈ ਕੀ ਤੁਹਾਡੇ ਕੋਲ ਪੂਰੇ ਸਾਧਨ ਹਨ ਕੀ ਇਹ ਕੋਫੀ ਮੇਰੇ ਤੱਕ ਗਰਮ ਗਰਮ ਪਹੁੰਚ ਜਾਵੇਗੀ ਜੇਕਰ ਨਹੀਂ ਹੈ ਤਾਂ ਮੈਨੂੰ ਹੁਣੇ ਦੱਸ ਦਿੱਤਾ ਜਾਵੇ ਮੈਂ ਤੁਹਾਡੀ ਰਾਸ਼ੀ ਔਨਲਾਈਨ ਪੇਅ ਕਰ ਦੇਵਾਂਗੀ ਤੁਹਾਡਾ ਬਹੁਤ ਬਹੁਤ ਧੰਨਵਾਦ